ਹਾਂਜੀ ਮੈਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਨੋਰੰਜਨ ਕਰਨਾ ਬਹੁਤ ਪਸੰਦ ਹੈ ਕਿਉਂਕਿ ਮੈਂ ਉਸ ਟਾਇਮ ਵਿੱਚ ਬਹੁਤ ਜ਼ਿਆਦਾ ਇੰਜੁਆਏ ਕਰਦੀ ਹਾਂ ਕਿਉਂਕਿ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੇ ਨਾਲ ਮੇਰੀਆਂ ਸਾਰੇ ਦੁੱਖ ਤਕਲੀਫਾਂ ਦੂਰ ਹੁੰਦੀਆਂ ਹਨ ਅਤੇ ਦੋਸਤ ਉਹ ਹੁੰਦੇ ਹਨ ਜੋ ਹਰ ਮੁਸ਼ਕਿਲ ਦੇ ਵਿੱਚ ਸਾਡਾ ਸਾਥ ਦਿੰਦੇ ਹਨ ਸਾਡਾ ਸਾਥ ਨਿਭਾਉਂਦੇ ਹਨ ਅਤੇ ਸਾਨੂੰ ਵਧੀਆ ਰਾਹ ਚੁਣਨ ਲਈ ਉਕਸਾਉਂਦੇ ਹਨ ਇਸ ਕਰਕੇ ਪਰਿਵਾਰ ਅਤੇ ਦੋਸਤ ਨਾਲ ਮਨੋਰੰਜਨ ਇੱਕ ਅਲੱਖ ਇੱਕ ਅਲੱਗ ਅੰਦਾਜ਼ਾ ਹੈ ਅਤੇ ਇਹ ਮੈਨੂੰ ਬਹੁਤ ਵਧੀਆ ਪਸੰਦ ਹੈ